ਮੇਰੇ ਕੋਲ ਸਿਹਤ ਸੰਭਾਲ ਬੀਮਾ ਆਪਣਾ ਤਾਂ ਨਹੀਂ ਹੈ ਪਰ ਸਿਹਤ ਸੰਭਾਲ ਬੀਮਾ ਮੇਰੇ ਭਾਪੇ ਦਾ ਬਣਿਆ ਹੈ ਤੇ ਉਹਨਾਂ ਨੇ ਆਪਣੇ ਇੱਕ ਵਾਰ ਉਹਨਾਂ ਦਾ ਐਕਸੀਡੈਂਟ ਹੋ ਚੁੱਕਿਆ ਸੀ ਮੋਟਰਸਾਈਕਲ ਦੇ ਉੱਤੇ ਤੇ ਸਾਡੇ ਪਿੰਡ ਦੇ ਇੱਕ ਬਹੁਤ ਜ਼ਿਆਦਾ ਚੰਗੇ ਇਨਸਾਨ ਨੇ ਉਹਨਾਂ ਦੀ ਹੈਲਪ ਕੀਤੀ ਉਹਨਾਂ ਨੂੰ ਚੱਕ ਕੇ ਬਰਨਾਲਾ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਕਿ ਉਹਨਾਂ ਨੂੰ ਆਪਣੇ ਸਿਹਤ ਸੰਭਾਲ ਬੀਮਾ ਦਾ ਇਸਤੇਮਾਲ ਕਰਨ ਦਾ ਮੌਕਾ ਮਿਲਿਆ ਤੇ ਅਸੀਂ ਸਰਕਾਰ ਦਾ ਬਹੁਤ ਜਿਆਦਾ ਧੰਨਵਾਦ ਵੀ ਕਰਦੇ ਆਂ ਵੀ ਉਹ ਉਹਨਾਂ ਨੇ ਇਹ ਤਰ੍ਹਾਂ ਦੀ ਸੁਵਿਧਾ ਜਿਹੜੀ ਉਪਲਬਧ ਕੀਤੀ ਤੇ ਲੋਕਾਂ ਨੂੰ ਆਪਣੇ ਸਿਹਤ ਸੰਬੰਧੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆ ਸਕਦੀ ਠੀਕ ਹੈ ਜੀ